ਹੈਲੋ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਓ ਜੀ ਠੀਕ ਠਾਕ ਹੋ ਬਹੁਤ ਵਧੀਆ ਪਰਿਵਾਰ ਠੀਕ ਠਾਕ ਸਾਰਾ ਬਹੁਤ ਹੀ ਵਧੀਆ ਜੀ ਕਿਰਪਾ ਮਾਲਕ ਦੀ ਤੁਸੀਂ ਸੁਣਾਓ ਸਭ ਠੀਕ ਠਾਕ ਹਾਂਜੀ ਕਿਵੇਂ ਯਾਦ ਕੀਤਾ ਜੀ ਅੱਜ ਹਾਂ ਜਾਣਕਾਰੀ ਮਤਲਬ ਇਤਿਹਾਸ ਅੱਛਾ ਅੱਛਾ ਫਿਰੋਜ਼ਪੁਰ ਦਾ ਇਤਿਹਾਸ ਵੀਰੇ ਫਿਰੋਜ਼ਪੁਰ ਦਾ ਇਤਿਹਾਸ ਬਹੁਤ ਹੀ ਵਧੀਆ ਜਿਹਦੇ ਵਿੱਚ ਬਹੁਤ ਸਾਰੀਆਂ ਲੜਾਈਆਂ ਦਾ ਕੇਂਦਰ ਵੀ ਰਿਹਾ ਇਹਦਾ ਨਾਮ ਚੌਧਵੀਂ ਪੰਦਰਵੀਂ ਸਦੀ ਦੇ ਵਿੱਚ ਨਾ ਫਿਰੋਜ਼ਸ਼ਾਹ ਤੁਗਲਕ ਰਾਜਾ ਹੋਇਆ ਉਹ ਨਾ ਕਿਸੇ ਬਿਮਾਰੀ ਨਾਲ ਪੀੜਿਤ ਸੀਗਾ ਅਤੇ ਉਹਨੂੰ ਉਹਦੇ ਜਿਹੜੇ ਹਕੀਮ ਸੀ ਨਾ ਉਹਨਾਂ ਕਿਹਾ ਸੀ ਵੀ ਤੁਸੀਂ ਨਾ ਕੋਈ ਇਹੋ ਜਿਹੀ ਥਾਂ 'ਤੇ ਜਾਓ ਜਿੱਥੇ ਬਹੁਤ ਹੀ ਜ਼ਿਆਦਾ ਹਰਿਆਲੀ ਹੋਵੇ ਅਤੇ ਤੁਹਾਡੇ ਇਸ ਬਿਮਾਰੀ ਦੇ ਮੌਸਮ ਅਨੁਕੂਲ ਹੈ ਜਦੋਂ ਖੋਜ ਕੀਤੀ ਉਹਨਾਂ ਨੂੰ ਇਹ ਵਾਲਾ ਏਰੀਆ ਸਭ ਤੋਂ ਵਧੀਆ ਲੱਗਿਆ ਜਿਹੜਾ ਫਿਰੋਜ਼ਪੁਰ ਦਾ ਏਰੀਆ ਉਹ ਇੱਥੇ ਆ ਕੇ ਵਸੇ ਉਹਨਾਂ ਇੱਥੇ ਆ ਕੇ ਆਪਣੀ ਛੋਅਣੀ ਬਣਾਈ ਅਤੇ ਥੋੜ੍ਹੀ ਦੇਰ ਬਾਅਦ ਉਹ ਨਾ ਬਿਲਕੁਲ ਠੀਕ ਹੋ ਗਿਆ ਅਤੇ ਫਿਰ ਉਹਨਾਂ ਨੇ ਪੱਕੇ ਤੌਰ 'ਤੇ ਇੱਥੇ ਰਹਿਣ ਦਾ ਬਣਾ ਲਿਆ ਵੀ ਮੈਂ ਪੱਕੇ ਤੌਰ 'ਤੇ ਹੀ ਇੱਥੇ ਸ਼ਿਫਟ ਹੋ ਜਾਣਾ ਤਾਂ ਉਦੋਂ ਉਹਨਾਂ ਆਪਣੇ ਉਹਨੇ ਆਪ ਦੀ ਰਹਿ ਰਿਹਾਇਸ਼ ਵਾਸਤੇ ਨਾ ਇੱਥੇ ਇੱਕ ਬਹੁਤ ਵੱਡਾ ਦੀਵਾਰ ਬਣਾਈ ਪੂਰਾ ਏਰੀਆ ਬਣਿਆ ਜਿਹਦੇ ਵੱਖ ਵੱਖ ਉਹਨੇ ਗੇਟ ਰੱਖੇ ਸੀ ਜਿਵੇਂ ਮੁਲਤਾਨ ਵੱਲ ਵੱਖਰਾ ਗੇਟ ਰੱਖਿਆ ਵਪਾਰ ਵਾਸਤੇ ਚੀਰੇ ਵਾਲੇ ਪਾਸੇ ਵੱਖਰਾ ਗੇਟ ਕਿਉਂਕਿ ਉਹਨੇ ਲਗਭਗ ਦਸ ਗੇਟ ਵੀ ਬਣਵਾਏ ਸੀਗੇ ਅਤੇ ਹੌਲੀ ਹੌਲੀ ਹੌਲੀ ਹੌਲੀ ਜਦੋਂ ਸਮਾਂ ਬੀਤਦਾ ਗਿਆ ਉਹ ਮਰ ਗਿਆ ਉਸ ਤੋਂ ਬਾਅਦ ਹੌਲੀ ਹੌਲੀ ਨਾ ਇੱਕ ਫਿਰੋਜ਼ ਸ਼ਾਹ ਤੁਗਲਕ ਤੋਂ ਹੌਲੀ ਹੌਲੀ ਫਿਰੋਜ਼ਪੁਰ ਹੀ ਬਣ ਗਿਆ ਇੱਥੇ ਹੋਰ ਵੀ ਬਹੁਤ ਹੀ ਇਤਿਹਾਸ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਹੋਏ ਨੇ ਸਿੱਖਾਂ ਦੇ ਉਹਨਾਂ ਦੀ ਚਰਨ ਸ਼ੋ ਵੀ ਪ੍ਰਾਪਤ ਹੈ ਇੱਥੇ ਇਤਿਹਾਸਿਕ ਗੁਰਦੁਆਰਾ ਬਜੀਦਪੁਰ ਤ ਜਾਮਨੀ ਸਾਹਿਬ ਬਣਿਆ ਹੋਇਆ ਉਹ ਦਸਵੇਂ ਗੁਰੂ ਪਾਤਸ਼ਾਹ ਦੀ ਯਾਦ ਵਿੱਚ ਬਣਾਇਆ ਗਿਆ ਹਾਂਜੀ ਇੱਥੇ ਸ਼ੇਰ ਸ਼ਾਹ ਵਾੜੀ ਦੀ ਦਰਗਾਹ ਵੀ ਹੈਗੀ ਹੈ ਜੋ ਕਿ ਬਹੁਤ ਇਤਿਹਾਸਿਕ ਹੈ ਅਤੇ ਬਹੁਤ ਪੁਰਾਣੀ ਹੈ ਉਦੋਂ ਫਿਰਜ਼ਸ਼ਾਹ ਤੁਗਲਕ ਨਾ ਬਾਕੀ ਦੇਸ਼ਾਂ ਦੇ ਨਾਲ ਸ਼ਹਿਰ ਨਾਲ ਵਪਾਰ ਕਰਨ ਵਾਸਤੇ ਨਾ ਲਗਭਗ ਦਸ ਤੋਂ ਬਾਰਾਂ ਗੇਟਾਂ ਦਾ ਨਿਰਮਾਣ ਕਰਵਾਇਆ ਸੀ ਜੇ ਗੇਟ ਅੱਜ ਵੀ ਮੌਜੂਦ ਨੇ ਜਿਹਨਾਂ ਵਿੱਚ ਮੁੱਖ ਦਿੱਲੀ ਗੇਟ ਵਾਸੀ ਗੇਟ ਜੀਰਾ ਗੇਟ ਬਗਦਾਦੀ ਗੇਟ ਅਤੇ ਵੱਖ ਵੱਖ ਸ਼ਹਿਰਾਂ ਵੱਲ ਜਿਵੇਂ ਜਿਵੇਂ ਵਪਾਰ ਕਰਦੇ ਸੀ ਉੱਦਾਂ ਦੇ ਗੇਟ ਉਹਨਾਂ ਬਣਵਾਏ ਨੇ ਉਹਨਾਂ ਦੇ ਨਾਂ 'ਤੇ ਹੀ ਫਿਰੋਜ਼ਪੁਰ ਦਾ ਨਾਂ ਫਿਰੋਜ਼ਸ਼ਾਹ ਦੇ ਨਾਮ 'ਤੇ ਹੀ ਫਿਰੋਜ਼ਪੁਰ ਦਾ ਨਾਮ ਫਰੀਦਕੋਟ ਪੈ ਗਿਆ ਹਾਂਜੀ ਜਿਹੜੇ ਸ਼ਾਰਾ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਹੈਗਾ ਉਹ ਨਾ ਜਿਹੜੀ ਸਾਰਾਗੜ੍ਹੀ ਲੜਾਈ ਹੋਈ ਸੀ ਨਾ ਸਿੱਖਾਂ ਦੇ ਵਿੱਚ ਅੰਗਰੇਜ਼ਾਂ ਦੇ ਵੇਲੇ ਸਿੱਖਾਂ ਦੇ ਮੁਗਲਾਂ ਦੇ ਵਿੱਚ ਦੇ ਮੁਗਲਾਣਾ ਅਫ਼ਗਾਨੀਆਂ 'ਚ ਲੜਾਈ ਹੋਈ ਸੀ ਸਾਰਾਗੜ੍ਹੀ ਦੀ ਥਾਂ 'ਤੇ ਜੋ ਕਿ ਦਰਾ ਖੈਬਰ ਦੇ ਏਰੀਏ 'ਚ ਮੌਜੂਦ ਹੈ ਜੋ ਅੱਜ ਵੈਹ ਪਾਕਿਸਤਾਨ ਦੇ ਵਿੱਚ ਚਲਾ ਗਿਆ ਅਤੇ ਉਹਨਾਂ ਦੀ ਯਾਦ ਦੇ ਵਿੱਚ ਫਿਰੋਜ਼ਪੁਰ ਵਿੱਚ ਸਾਰਾਗੜ੍ਹੀ ਗੁਰਦੁਆਰਾ ਬਣਾਇਆ ਗਿਆ ਹਾਂਜੀ ਹਾਂਜੀ ਉਹ ਜਿਹੜੇ ਇੱਕੀ ਸਿੱਖ ਸ਼ਹੀਦ ਹੋਏ ਨਾ ਸਾਰਾਗੜ੍ਹੀ ਲੜਾਈ ਦੇ ਵਿੱਚ ਦੁਨੀਆਂ ਦੀ ਸਭ ਤੋਂ ਮਹੱਤਵਪੂਰਨ ਟੋਪ ਦੀਆਂ ਪੰਜ ਜੰਗਾਂ ਵਿੱਚ ਸਾਰਾਗੜ੍ਹੀ ਲੜਾਈ ਵੀ ਆਉਂਦੀ ਹੈ ਉੱਥੇ ਇੱਕੀ ਸਿੰਘ ਸ਼ਹੀਦ ਹੋਏ ਸੀਗੇ ਉਹਨਾਂ ਦੀ ਯਾਦ ਵਿੱਚ ਫਿਰੋਜ਼ਪੁਰ 'ਚ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਜਦੋਂ ਅੰਗਰੇਜ਼ਾ ਦਾ ਰਾਜ ਹੋ ਗਿਆ ਸੀ ਨਾ ਫਿਰ ਇੱਥੇ ਉਹਨਾਂ ਨੇ ਫਿਰੋਜ਼ਪੁਰ ਇੱਕ ਮੇਨ ਕੇਂਦਰ ਸੀ ਜਿਵੇਂ ਅੱਜ ਕੱਲ੍ਹ ਲੁਧਿਆਣਾ ਜਾਂ ਚੰਡੀਗੜ੍ਹ ਹੈ ਇੱਥੇ ਉਹਨਾਂ ਬਹੁਤ ਹੀ ਜਾਨ ਨਿਰਮਾਣ ਕਰਵਾਇਆ ਰੇਲਵੇ ਲਾਈਨਾਂ ਵਿਛਾਈਆਂ ਆਪਣੀ ਛੋਅਣੀ ਬਣਾਈ ਵੀ ਵਪਾਰ ਅੰਗਰੇਜ਼ਾਂ ਵੇਲੇ ਵਪਾਰ ਦਾ ਸਭ ਤੋਂ ਮੁੱਖ ਕੇਂਦਰ ਫਿਰੋਜ਼ਪੁਰ ਸੀ ਅੱਜ ਵੀ ਦਿੱਲੀ ਨੂੰ ਜਾਂ ਕਲਕੱਤੇ ਨੂੰ ਜਾਂ ਦੋ ਦੋ ਜੇ ਮੁਲਕ ਕੋਈ ਵੀ ਰੇਲਵੇ ਦਾ ਕੰਮ ਹੁੰਦਾ ਤਾਂ ਫਿਰੋਜ਼ਪੁਰ ਵਿੱਚ ਕੀਤਾ ਜਾਂਦਾ ਹੁਣ ਇਤਿਹਾਸਿਕ ਪੱਖੋਂ ਫਿਰੋਜ਼ਪੁਰ ਬਹੁਤ ਹੀ ਇਤਿਹਾਸਿਕ ਸ਼ਹਿਰ ਹੈ ਇਹ ਤਾਂ ਜਦੋਂ ਸਨਤਾਲੀ ਦੀ ਵੰਡ ਵੇਲੇ ਇੱਕ ਸਰਹੱਦੀ ਸੂਬਾ ਬਣ ਗਿਆ ਤਾਂ ਉਹਦੀ ਵਜ੍ਹਾ ਕਰਕੇ ਥੋੜ੍ਹਾ ਜਿਹਾ ਬੈਕਵਰਡ ਏਰੀਆ ਹੋ ਗਿਆ ਹੌਲੀ ਹੌਲੀ ਇਹਨੂੰ ਤੋੜ ਤੋੜ ਕੇ ਛੋਟਾ ਕਰ ਦਿੱਤਾ ਗਿਆ ਨਹੀਂ ਉਹ ਫਿਰੋਜ਼ਪੁਰ ਦੀ ਸੀਗੀਆਂ ਅਬੋਹਰ ਤੱਕ ਫਿਰੋਜ਼ਪੁਰ ਦੀ ਸਰਹੰਦ ਲੱਗਦੀ ਸੀ ਜਿਹਨੂੰ ਅੱਜ ਕੱਲ੍ਹ ਜਿਹੜਾ ਫਾਜ਼ਿਲਕਾ ਵਿੱਚ ਦਿੱਤਾ ਗਿਆ

ਹੋਰ ਸੇਵਾ ਜੀ ਜੇ ਜ਼ਿਆਦਾ ਤੁਸੀਂ ਡਿਟੇਲ ਲੈਣੀ ਹੈ ਜੇ ਆਪਾਂ ਕਿਤੇ ਮਿਲਕੇ ਬੈਠਾਗਾਂ ਨਾ ਤੁਹਾਨੂੰ ਉਦੋਂ ਪੂਰੀ ਡਿਟੇਲ ਦੱਸਾਂਗਾ ਫੋਨ 'ਤੇ ਇੰਨੀ ਲੰਬੀ ਗੱਲ ਨਹੀਂ ਹੋ ਸਕਦੀ ਹੈਗੀ ਜਦੋਂ ਵੀ ਮਿਲਗੀ ਉਸ ਟੈਮ ਬਸ ਤੁਹਾਨੂੰ ਪੂਰੀ ਡਿਟੇਲ ਬਾਰੇ ਦੱਸ ਦਾਿਆਂਗਾ ਅਤੇ ਫਿਰੋਜ਼ਪੁਰ ਦਾ ਇਤਿਹਾਸ ਕੀ ਹੈ ਗੌਰਵਮਈ ਇਤਿਹਾਸ ਹੈ ਬਹੁਤ ਹੀ ਲੜਾਈਆਂ ਦਾ ਕੇਂਦਰ ਬਣਿਆ ਰਿਹਾ ਫਿਰੋਜ਼ਪੁਰ ਜਦੋਂ ਸਿੱਖ ਐਂਗਲੋ ਵਾਰ ਹੋਈ ਹੈ ਲਾਸਟ ਸ਼ਾਮ ਸਿੰਘ ਅਟਾਰੀ ਦੇ ਅਤੇ ਅੰਗਰੇਜ਼ਾਂ ਦੇ ਵਿਚਕਾਰ ਉਹਨਾਂ ਦੀ ਮੇਨ ਜੋ ਜੰਗ ਦਾ ਮੈਦਾਨ ਬਣਿਆ ਸੀ ਫਿਰੋਜ਼ਪੁਰ ਸ਼ਹਿਰ ਸੀ ਬਣਿਆ ਠੀਕ ਹੈ ਵੀਰੇ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਧੰਨਵਾਦ